ਇਕੱਤੀ ਸਤੰਬਰ ਦੋ ਹਜ਼ਾਰ ਸੋਲ੍ਹਾਂ ਅਠਾਈ ਅਗਸਤ ਦੋ ਹਜ਼ਾਰ ਪੰਜ ਦੋ ਸਤੰਬਰ ਦੋ ਹਜ਼ਾਰ ਤੇ ਤੇਰਾਂ ਉਨੱਤੀ ਮਾਰਚ ਦੋ ਹਜ਼ਾਰ ਚ ਚੌਵੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ